ਹੈਲੋ ਹਾਂਜੀ ਹਾਂਜੀ ਹਾਂਜੀ ਤੁਸੀਂ ਕੌਣ ਬੋਲਦੇ ਹੋ ਹਾਂਜੀ ਠੀਕ ਹੈ ਹਾਂਜੀ ਹਾਂਜੀ ਸਾਡੇ ਕੋਲ ਦੁੱਧ ਮਿਲਦਾ ਦਹੀਂ ਮਿਲਦੀ ਹੈ ਪਨੀਰ ਮਿਲਦਾ ਔਰ ਘਿਓ ਮਿਲਦਾ ਤੁਹਾਨੂੰ ਕੀ ਚਾਹੀਦਾ ਆਪਣੇ ਕੋਲ ਆਉਂਦਾ ਵੇਰਕਾ ਆਂਦਾ ਸੁਪਰ ਦਾ ਆਂਦਾ ਅਮੁਲ ਦਾ ਆਂਦਾ ਤੁਹਾਨੂੰ ਕਿਹੜਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਮਿਲਦਾ ਫਰੈਸ਼ ਦੁੱਧ ਅਮੁਲ ਦਾ ਫੁੱਲ ਕ੍ਰੀਮ ਦਾ ਤਾਂ ਰੇਟ ਹੈਗਾ ਸੱਤਰ ਹਾਂਜੀ ਤੇ ਵੇਰਕਾ ਦਾ ਹੈਗਾ ਛਿਆਟ ਰੁਪਏ ਤੇ ਸੁਪਰ ਦਾ ਹੈਗਾ ਆਪਣੇ ਕੋਲ ਚੋਹਟ ਰੁਪਏ ਪਨੀਰ ਵੀ ਆਪਣੇ ਕੋਲ ਮਿਲ ਜਾਏਗਾ ਪਨੀਰ ਪਏਗਾ ਆਪਾਂ ਨੂੰ ਦੋ ਸੋ ਚਾਲੀ ਰੁਪਏ ਕਿਲੋ ਹਾਂਜੀ ਹਾਂਜੀ ਦੁੱਧ ਡੇਲੀ ਆਉਂਦਾ ਦੁੱਧ ਡੇਲੀ ਆਉਂਦਾ ਦਹੀਂ ਆਪਣੇ ਕੋਲ ਡੇਲੀ ਆਉਂਦੀ ਐ ਪਨੀਰ ਡੇਲੀ ਆਉਂਦਾ ਘਿਓ ਅਸੀਂ ਹਫਤੇ ਬਾਅਦ ਮੰਗਾਉਦੇ ਆ ਹਾਂਜੀ ਤੁਹਾਨੂੰ ਕਦੋਂ ਕਦੋਂ ਚਾਹੀਦਾ ਅੱਛਾ ਦੇਖੋ ਅਗਰ ਜਲਦੀ ਦੁੱਧ ਆ ਜਾਂਦਾ ਸਰ ਤਾਂ ਅਸੀਂ ਪਹੁੰਚਾ ਦਿਆਂਗੇ ਤੁਹਾਨੂੰ ਤੁਸੀਂ ਘਰ ਹੋਣੇ ਚਾਹੀਦੇ ਹੋ ਸੱਤ ਵਜੇ ਵੀ ਆ ਜਾਂਦਾ ਕਦੇ ਕਦੇ ਛੇ ਵਜੇ ਵੀ ਆ ਜਾਂਦਾ ਆਹ ਜਿਵੇਂ ਹੁਣ ਸਰਦੀਆਂ ਕਰਕੇ ਥੋੜਾ ਜਿਹਾ ਲੇਟ ਵੀ ਹੋ ਜਾਂਦਾ ਥਾਨੂੰ ਕਿੰਨੇ ਵਜੇ ਚਾਹੀਦਾ ਹਾਂ ਪਹੁੰਚਾ ਦਿਆਂਗੇ ਇਦਾ ਹੀ ਨਹੀਂ ਚਾਹੀਦੀ ਤੁਹਾਨੂੰ ਹਾਂਜੀ ਹਾਂਜੀ ਡੇਟ ਉਹਦੇ ਤੇ ਲਿਖੀ ਹੁੰਦੀ ਐ ਅੱਛਾ ਦੋ ਲੀਟਰ ਡੇਲੀ ਤੁਹਾਨੂੰ ਘਰ ਚਾਹੀਦਾ ਅੱਛਾ

ਕਰ ਸਕਦੇ ਹੋ ਡੇਲੀ ਦਾ ਡੇਲੀ ਵੀ ਦੇ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਅਮੁਲ ਦਾ ਦੁੱਧ ਤਾਂ ਫੁੱਲ ਕਰੀਮ ਵਾਲਾ ਬਹੁਤ ਵਧੀਆ ਹਾਂਜੀ ਦੇਸੀ ਘਿਓ ਦਹੀ ਹਾਂਜੀ ਫਰੈਸ਼ ਓਹੀ ਆ ਫੁੱਲ ਕਰੀਮ ਵਾਲਾ ਪੈਂਦਾ ਆਪਾਂ ਨੂੰ ਸੱਤਰ ਰੁਪਏ ਤੇ ਦੂਸਰਾ ਪਏਗਾ ਆਪਾਂ ਨੂੰ ਬਾਹਟ ਰੁਪਏ ਹਾਂਜੀ ਹਾਂਜੀ ਚਲੋ ਤੁਸੀਂ ਜਿੰਨੇ ਵਜੇ ਕਹੋਗੇ ਪਹੁੰਚਾ ਦਿਆਂਗੇ ਤੁਹਾਨੂੰ ਠੀਕ ਐ ਜੀ ਠੀਕ ਐ ਠੀਕ ਐ ਓਕੇ